ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਹਿਕ ਹੈ ਮੈਂ ਤੁਹਾਡੇ ਰੈਸਟੋਰੈਂਟ ਸਪਾਈਸ ਰੈਸਟੋਰੈਂਟ ਤੋਂ ਗੱਲ ਕਰਦੇ ਪਏ ਹੋ ਮੈਂ ਤੁਹਾਡੇ ਰੈਸਟੋਰੈਂਟ ਦੇ ਔਡਰ ਦਿੱਤਾ ਸੀ ਹਾਂਜੀ ਔਡਰ ਦੇ ਵਿੱਚ ਮੈਂ ਤਿੰਨ ਬਰਗਰ ਚਾਰ ਪੀਜਾ ਤਿੰਨ ਡੋਸਾ ਅਤੇ ਦੋ ਕੋਲਡਰਿੰਕਸ ਸੀਗੇ ਅਤੇ ਤੁਹਾਡਾ ਔਡਰ ਹਜੇ ਤੱਕ ਮੇਰੇ ਕੋਲ ਪਹੁੰਚਿਆ ਨਹੀਂ ਹੈ ਹਾਂਜੀ ਮੈਂ ਤੁਹਾਡੀ ਰਾਈਡਰ ਨਾਲ ਵੀ ਗੱਲ ਕਰਨ ਦਾ ਟ੍ਰਾਈ ਕੀਤਾ ਪਰ ਉਹਨਾਂ ਨਾਲ ਵੀ ਗੱਲ ਨਹੀਂ ਹੋ ਪਾ ਰਹੀ ਮੈਂ ਕਾਫੀ ਦੇਰ ਦਾ ਔਡਰ ਦਿੱਤਾ ਹੁਣ ਦੋ ਘੰਟੇ ਹੋ ਚੁੱਕੇ ਨੇ ਪਰ ਨਾ ਤਾਂ ਕੋਈ ਕਾਲ ਆ ਰਿਹਾ ਅਗਰ ਲੋਕੇਸ਼ਨ ਮੈਂ ਆਨ ਕਰ ਰਹੀ ਹੈ ਤਾਂ ਉਹਨਾਂ ਦੀ ਲੋਕੇਸ਼ਨ ਵੀ ਨਹੀਂ ਮੈਨੂੰ ਸ਼ੋ ਹੋ ਰਹੀ ਪਲੀਜ਼ ਅਗਰ ਤੁਸੀਂ ਉਹਨਾਂ ਦਾ ਕੋਈ ਦੂਸਰਾ ਨੰਬਰ ਹੈ ਤਾਂ ਮੈਨੂੰ ਦੱਸ ਸਕਦੇ ਹੋ ਹਾਂਜੀ ਮੈਂ ਅਰਜੈਂਟ ਔਡਰ ਸੀਗਾ ਇਸ ਕਰਕੇ ਮੈਂ ਤੁਹਾਨੂੰ ਕਹਿ ਰਹੀ ਸੀਗੀ ਅਗਰ ਪਲੀਜ਼ ਤੁਹਾਡੇ ਕੋਲ ਉਹਨਾਂ ਦਾ ਨੰਬਰ ਹੈ ਤਾਂ ਦੱਸ ਦੋ ਅਗਰ ਨਹੀਂ ਔਡਰ ਡਿਲੀਵਰੀ ਹੋ ਸਕਦਾ ਤਾਂ ਤਾਂ ਵੀ ਦੱਸ ਦਿਓ ਮੈਂ ਕਿਸੇ ਦੂਸਰੇ ਰੈਂਟ ਰੈਸਟੋਰੈਂਟ ਤਾਂ ਗੱਲ ਕਰ ਲਵਾਂ ਉਹਨਾਂ ਕੋਲ ਮੰਗਾਉਣਾ ਕਿਉਂਕਿ ਸਾਡੇ ਘਰ ਗੈਸਟ ਆਏ ਹੋਏ ਨੇ ਅਤੇ ਇਸ ਕਰਕੇ ਮੈਂ ਕਹਿ ਰਹੀ ਸੀ ਹਾਂਜੀ ਪਲੀਜ਼ ਉਹਨਾਂ ਨੂੰ ਕਾਲ ਕਰ ਕੇ ਪੁੱਛ ਦਿਓ ਥੈਂਕ ਯੂ